ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੁਲਾਟੀ ਸ਼ੋਪ ਤੋਂ ਬੋਲਦੇ ਹੋ ਅਤੇ ਮੈਂ ਤੁਹਾਡੇ ਤੋਂ ਫੂਟਵੇਅਰ ਬਾਰੇ ਪਤਾ ਕਰਨਾ ਸੀ ਲੇਡੀਜ਼ ਬਾਰੇ ਕਿ ਪੰਜਾਬੀ ਜੁੱਤੀ ਵਰਗੀ ਹਾਂਜੀ ਅਤੇ ਉਨ੍ਹਾਂ ਦੇ ਤੁਸੀਂ ਮੈਨੂੰ ਰੇਟ ਦੱਸ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਅਛ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਜਿਵੇਂ ਜੈਂਟਸ ਵਗੈਰਾ ਦੇ ਹੋ ਗਏ ਫੁੱਟਵੇਅਰ ਅੱਛਾ ਜੀ ਅਤੇ ਉਸ ਤੋਂ ਬਾਅਦ ਲੇਡੀਜ਼ ਦੀ ਵੈਲੀ ਦੱਸੂਗੇ ਉਹਨਾਂ ਦਾ ਕੀ ਪ੍ਰਾਈਜ਼ ਰਹੂਗਾ ਅਤੇ ਡਿਜ਼ਾਈਨ ਕਿਵੇਂ ਦਾ ਰਹੂਗਾ ਉਨ੍ਹਾਂ ਦਾ ਅੱਛ ਅੱਛਾ ਜੀ ਅਤੇ ਉਨ੍ਹਾਂ ਦਾ ਰੇਟ ਅੱਛਾ ਜੀ ਅਤੇ ਉਸ ਤੋਂ ਬਾਅਦ ਹੀਲ ਬਾਰੇ ਤੁਸੀਂ ਦੱਸ ਸਕਦੇ ਹੋ ਜਿਵੇਂ ਪਾਰਟੀਵੇਅਰ ਵਗੈਰਾ ਲੈਣੀ ਹੋਵੇ ਅੱਛਾ ਅੱਛਾ ਜੀ ਅਤੇ ਉਸ ਤੋਂ ਬਾਅਦ ਬੱਚਿਆਂ ਬਾਰੇ ਅੱਛਾ ਜੀ ਅੱਛ ਠੀਕ ਹੈ ਜੀ ਠੀਕ ਹੈ ਚੱਲੋ ਠੀਕ ਹੈ ਜੀ ਤੁਹਾਡੇ ਕੋਲ ਕੱਲ੍ਹ ਨੂੰ ਆਵਾਂਗੇ ਤੁਹਾਡਾ ਧੰਨਵਾਦ ਬਹੁਤ ਬਹੁਤ ਠੀਕ ਹੈ ਓਕੇ